ਸਤਿ ਸ਼੍ਰੀ ਅਕਾਲ ਜੀ ਮੈਂ ਲਵਪ੍ਰੀਤ ਬੋਲ ਰਿਹਾ ਮੋਹਾਲੀ ਤੋਂ ਤੁਹਾਡੀ ਸਾਈਟ ਤੋਂ ਨਾ ਮੈਂ ਇੱਕ ਓਵਨ ਓਡਰ ਕੀਤਾ ਸੀਗਾ ਅਤੇ ਇਹਦੀ ਡਿਲੀਵਰੀ ਮੈਨੂੰ ਪੰਦਰ੍ਹਾਂ ਦਿਨ ਦੱਸੀ ਗਈ ਸੀਗੀ ਅਤੇ ਆਹਾ ਤਿੰਨ ਮਹੀਨੇ ਬਾਅਦ ਡਿਲੀਵਰ ਹੋਇਆ ਅਤੇ ਇਹਦੀ ਪੈਕਿੰਗ ਵੀ ਬਹੁਤ ਮਾੜੀ ਕੀਤੀ ਹੋਈ ਸੀਗੀ ਮਤਲਬ ਕਿ ਪਤਲੇ ਜਿਹੇ ਨਿਊਜ਼ਪੇਪਰ ਨਾਲ਼ ਹੋਈ ਹੋਈ ਸੀਗੀ ਕੋਈ ਸੇਫ ਨਹੀਂ ਸੀਗਾ ਇਹਦੇ 'ਚ ਕਲਰ ਵੀ ਮੈਂ ਇਹਦਾ ਰੈੱਡ ਕਲਰ ਚੂਜ਼ ਕੀਤਾ ਸੀਗਾ ਪਰ ਮੈਨੂੰ ਪਹੁੰਚਿਆ ਬਲੂ ਆ ਅਤੇ ਬਰੇਕ ਵੀ ਹੋਇਆ ਸੀਗਾ ਇਹਦਾ ਮਿਰਰ ਹੈ ਜੋ ਬਾਹਰ ਵਾਲ਼ਾ ਉਹ ਟੁੱਟਿਆ ਹੋਇਆ ਸੀਗਾ ਅੰਦਰੋਂ ਸਟੈਂਡ ਉਹ ਵੀ ਖਤਮ ਟੁੱਟਿਆ ਹੋਇਆ ਸੀਗਾ ਅਤੇ ਭਾਂਡੇ ਵੀ ਤੁਸੀਂ ਕਿਹਾ ਸੀ ਕਿ ਵੀ ਭਾਂਡੇ ਵੀ ਨਾਲ਼ ਮਿਲਣਗੇ ਪਰ ਕੋਈ ਮੈਨੂੰ ਐਵੇਂ ਦਾ ਕੁਛ ਨਹੀਂ ਮਿਲਿਆ ਅਤੇ ਮੈਂ ਤੁਹਾਡੀ ਇਸ ਤ ਤੋਂ ਹੈਪੀ ਨਹੀਂ ਹੈਗਾ ਅਤੇ ਤੁਸੀਂ ਮੇਰਾ ਰੀਫੰਡ ਕੀਤਾ ਜਾਵੇ ਜਾਂ ਮੇਰਾ ਓਡਰ ਚੇਂਜ ਕਰ ਦਿਉ ਜਾਂ ਮੇਰੇ ਪੈਸੇ ਜਿੰਨੇ ਰਸੀਵ ਉਹ ਵਾਪਸ ਕਰ ਦਿਉ ਬਾਕੀ ਮੈਂ ਆਪਣੇ ਫਰੈਂਡਜ਼ ਨੂੰ ਵੀ ਦੱਸਾਗਾਂ ਬਈ ਇਸ ਵੈੱਬਸਾਈਟ ਤੋਂ ਮੰਗਵਾਉਣ ਦੀ ਲੋੜ ਨਹੀਂ ਹੈਗੀ ਕੋਈ ਵਧੀਆ ਸਰਵਿਸ ਨਹੀਂ ਹੈਗੀ ਇਨ੍ਹਾਂ ਦੀ ਬਸ ਜਾਂ ਮੇਰੇ ਪੈਸੇ ਰਿਫੰਡ ਹੋ ਜਾਣ ਜਾਂ ਮੇਰਾ ਓਡਰ ਚੇਂਜ ਕਰ ਦਿਉ ਜਿਵੇਂ ਦਾ ਮੈਂ ਵੇਖਿਆ ਸੀਗਾ ਸਤਿ ਸ਼੍ਰੀ ਅਕਾਲ